ਉਹ ਇੱਕ ਮੋਬਾਈਲ ਹੀ ਟੈਕਨੋਲਜੀ ਇਹੋ ਜਿਹੀ ਹੈ ਜਿਸ ਤੋਂ ਬਿਨ੍ਹਾਂ ਅਸੀਂ ਨਹੀਂ ਰਹਿ ਸਕਦੇ ਉਸ ਦਾ ਕਾਰਨ ਇਹ ਹੈ ਕਿ ਅਸੀਂ ਇਸ ਨੂੰ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਕੰਮ ਦੇ ਲਈ ਵਰਤੋਂ ਦੇ ਵਿੱਚ ਰੱਖਦੇ ਹਾਂ ਜਿਵੇਂ ਕਿ ਕਿਸੇ ਨੂੰ ਫੋਨ ਦੇ ਉੱਤੇ ਸੁਨੇਹਾ ਦੇਣਾ ਵਟਸਅਪ ਦੇ ਉੱਤੇ ਮੈਸੇਜ ਕਰਨਾ ਜਾਂ ਅਨੇਯ ਪ੍ਰਕਾਰ ਦੀਆਂ ਅਸੀਂ ਕਿਸੇ ਨਾਲ ਤਾਲਮੇਲ ਬਣਾਉਣ ਦੇ ਲਈ ਇਸ ਐਪ ਦੀ ਇਸ ਫੋਨ ਦੀ ਵਰਤੋਂ ਕਰਦੇ ਹਾਂ ਫੋਨ ਇੱਕ ਅਜਿਹੀ ਟੈਕਨੋਲਜੀ ਹੈ ਜੋ ਕਿ ਹਰ ਇੱਕ ਇਨਸਾਨ ਦੇ ਲਈ ਇੱਕ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ ਫੋਨ ਨਾ ਕਿ ਸਿਰਫ ਅਸੀਂ ਕੌਲ ਦੇ ਲਈ ਹੀ ਜਾਂ ਬਲਕੀ ਇਸ ਨੂੰ ਅਸੀਂ ਮਨੋਰੰਜਨ ਦੇ ਲਈ ਹੀ ਵਰਤ ਸਕਦੇ ਹਾਂ ਮਨੋਰੰਜਨ ਦੇ ਲਈ ਜਿਵੇਂ ਕਿ ਯੂਟਿਊਬ ਇੰਸਟਾਗ੍ਰਾਮ ਆਦਿ 'ਤੇ ਅਸੀਂ ਮਨੋਰੰਜਨ ਕਰ ਸਕਦੇ ਹਾਂ ਇਸ ਤੋਂ ਇਲਾਵਾ ਅਸੀਂ ਇਸ ਨੂੰ ਇੱਕ ਕੈਲਕੂਲੇਸ਼ਨ ਤੌਰ ਦੇ ਲਈ ਵਰਤ ਸਕਦੇ ਹਾਂ ਫਿਰ ਇਸ ਤੋਂ ਇਲਾਵਾ ਇਸ ਤੋਂ ਅਸੀਂ ਸੋਂਗਜ਼ ਵਗੈਰਾ ਸੁਣ ਸਕਦੇ ਹਾਂ ਫੋਨ ਦੇ ਰਾਹੀਂ ਅਸੀਂ ਕਿਸੇ ਦਿਲਕਸ਼ ਨਜ਼ਾਰੇ ਨੂੰ ਫੋਨ ਦੇ ਵਿੱਚ ਅਸੀਂ ਕੈਪਚਰ ਕਰ ਸਕਦੇ ਹਾਂ ਥਰੂ ਕੈਮਰਾ ਫੋਨ ਦੇ ਰਾਹੀਂ ਅਸੀਂ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਜਾਣ ਲਈ ਨੈਵੀਗੇਸ਼ਨ ਦੀ ਵਰਤੋਂ ਕਰ ਸਕਦੇ ਹਾਂ ਜੋ ਕਿ ਇੱਕ ਸਾਡੇ ਲਈ ਮਹੱਤਵਪੂਰਨ ਚੀਜ਼ ਹੈ ਫੋਨ ਦੇ ਰਾਹੀਂ ਅਸੀਂ ਆਪਣੀਆਂ ਯਾਦਾਂ ਜਿਵੇਂ ਕਿ ਫੋਟੋਸ ਵੀਡੀਓ ਦੇ ਵਿੱਚ ਰੱਖ ਸਕਦੇ ਹਾਂ ਫੋਨ ਦੇ ਉੱਤੇ ਅਸੀਂ ਕਿਸੇ ਨੂੰ ਮੇਲ ਕਰ ਸਕਦੇ ਹਾਂ ਫੋਨ ਦੇ ਰਾਹੀਂ ਹੀ ਅਸੀਂ ਬੈਂਕਿੰਗ ਸਿਸਟਮ ਦੇ ਰਾਹੀਂ ਅਦਾਨ ਪ੍ਰਦਾਨ ਕਰ ਸਕਦੇ ਹਾਂ ਜਿਵੇਂ ਕਿ ਫੋਨ ਦੇ ਉੱਤੇ ਗੂਗਲ ਪੇ ਫੋਨਪੇ ਐਮਾਜ਼ੋਨ ਮੋਬੀਕਵਿਕ ਪੇਟੀਐੱਮ ਆਦਿ ਅਸੀਂ ਵਰਤਦੇ ਹਾਂ ਫੋਨ ਦੇ ਵਿੱਚ ਅਸੀਂ ਡਰਾਈਵ ਦਾ ਓਪਸ਼ਨ ਕਰਕੇ ਉਸ ਵਿੱਚ ਆਪਣੇ ਰੂਟੀਨ ਦੇ ਕੁਛ ਵਿਚਾਰ ਸੇਵ ਕਰ ਕੇ ਰੱਖ ਸਕਦੇ ਹਾਂ ਫੋਨ ਦੇ ਵਿੱਚ ਅਸੀਂ ਗੂਗਲ ਟ੍ਰਾਂਜੈਕਸ਼ਨ ਦੇ ਰਾਹੀਂ ਇੱਕ ਲੈਂਗੂਏਜ ਤੋਂ ਦੂਸਰੀ ਲੈਂਗੂਏਜ ਦੇ ਰਾਹੀਂ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਫੋਨ ਦੇ ਰਾਹੀਂ ਅਸੀਂ ਕੋਈ ਸ਼ੋਪਿੰਗ ਵਗੈਰਾ ਵੀ ਕਰ ਸਕਦੇ ਹਾਂ ਜਿਵੇਂ ਕਿ ਐਮਾਜ਼ੋਨ ਪੇਟੀਐੱਮ ਫੋਨ ਫਲਿਪਕਾਟ ਆਦਿ ਵਗੈਰਾ ਅਸੀਂ ਯੂਜ ਕਰਦੇ ਹਾਂ ਧੰਨਵਾਦ